ਸਾਡੇ ਖੇਤਰ ਵਿੱਚ ਦੇਖੇ ਜਾਣ ਵਾਲੇ ਪੰਛੀ ਬਹੁਤ ਘੱਟ ਹਨ ਜੋ ਕਿ ਆਮ ਦੇਖਣ ਨੂੰ ਮਿਲਦੇ ਹਨ ਜਿਵੇਂ ਮੋਰ ਕਬੂਤਰ ਤੋਤਾ ਅਤੇ ਚਿੜੀ ਘੁੱਗੀ ਇੱਲ ਮੇਰੇ ਮਨਪਸੰਦ ਦਾ ਕਿਸਮ ਦਾ ਪੰਛੀ ਮੋਰ ਹੈ ਮੋਰ ਹਰ ਇੱਕ ਨੂੰ ਪਸੰਦ ਹੁੰਦਾ ਹੈ ਮੈਨੂੰ ਮੋਰ ਦੇ ਖੰਭ ਬਹੁਤ ਸੋਹਣੇ ਲੱਗਦੇ ਹਨ ਅਕਸਰ ਉਦੋਂ ਜਦੋਂ ਉਹ ਪੈਲ ਪਾਉਂਦਾ ਹੈ ਹੁੰਦਾ ਹੈ ਮੋਰ ਰੋਜ਼ ਸਾਡੇ ਘਰ ਦੇ ਪਿੱਛੇ ਦੇਖਣ ਨੂੰ ਮਿਲਦਾ ਹਨ ਸਾਡੇ ਗੁਆਂਢੀ ਰੋਜ਼ ਉਹਨਾਂ ਨੂੰ ਦਾਣਾ ਪਾਉਂਦੇ ਹਨ ਮੋਰ ਦੀ ਆਵਾਜ਼ ਵੀ ਮੈਨੂੰ ਬਹੁਤ ਪਸੰਦ ਹੈ ਲੱਗਦੀ ਹੈ ਪੰਛੀਆਂ ਨੂੰ ਹਰ ਰੋਜ਼ ਦੇਖਣਾ ਬਹੁਤ ਵਧੀਆ ਲੱਗਦਾ ਹੈ